ਸਮੇਂ ਦੇ ਨਾਲ ਯੋਗਾ ਦਾ ਅਭਿਆਸ ਮੈਨੂੰ ਬਹੁਤ ਵਧੀਆ ਲੱਗਣ ਲੱਗ ਪਿਆ ਹੈ ਯੋਗਾ ਨੂੰ ਮੈਂ ਆਪਣੀ ਦਿਨਚਰਿਆ ਦਾ ਹਿੱਸਾ ਬਣਾ ਲਿਆ ਹੈ ਮੇਰੀ ਕੋਈ ਵੀ ਸਵੇਰ ਇਸ ਤਰ੍ਹਾਂ ਨਹੀਂ ਹੁੰਦੀ ਕਿ ਜਿਸ ਵਿੱਚ ਮੈਂ ਯੋਗਾ ਨਾਲ ਇਸ ਦੀ ਸ਼ੁਰੂਆਤ ਨਾ ਕਰਾਂ ਯੋਗਾ ਤੋਂ ਬਿਨ੍ਹਾਂ ਮੈਨੂੰ ਹਰ ਸਵੇਰ ਅਧੂਰੀ ਹੀ ਜਾਪਦੀ ਹੈ ਇਸ ਨੂੰ ਮੈਂ ਆਪਣੇ ਜ਼ਿੰਦਦਗੀ ਦੇ ਤਜ਼ਰਬੇ ਵਿੱਚ ਹਮੇਸ਼ਾਂ ਲਈ ਸ਼ਾਮਿਲ ਕਰ ਲਿਆ ਹੈ ਯੋਗ ਕਰਨ ਦੇ ਨਾਲ ਮੈਨੂੰ ਸਾਰਾ ਦਿਨ ਆਪਣੇ ਸਰੀਰ ਵਿੱਚ ਸ਼ਕਤੀ ਮਹਿਸੂਸ ਹੁੰਦੀ ਹੈ ਸਾਹ ਨੂੰ ਕੰਟਰੋਲ ਕਰਕੇ ਅੰਦਰ ਜਾਂਦੇ ਅਤੇ ਬਾਹਰ ਜਾਂਦੇ ਸਾਹ ਦੀਆਂ ਕਿਰਿਆਵਾਂ ਕਰਨ ਨਾਲ ਸਾਨੂੰ ਆਪਣੇ ਮਨ ਅਤੇ ਬੁੱਧੀ 'ਤੇ ਕੰਟਰੋਲ ਕਰਨ ਦੀ ਵੀ ਮਾਸਟਰੀ ਪ੍ਰਾਪਤ ਹੋ ਜਾਂਦੀ ਹੈ ਇਸ ਨੂੰ ਕਰਨ ਦੇ ਲਈ ਕੋਈ ਵੀ ਖਰਚਾ ਨਹੀਂ ਲੱਗਦਾ ਬਸ ਸਮੇਂ ਸਿਰ ਉੱਠ ਕੇ ਤਿਆਰ ਹੋ ਕੇ ਤੁਹਾਨੂੰ ਇਕਾਗਰ ਚਿੱਤ ਹੋ ਕੇ ਇਕ ਜਗ੍ਹਾ ਬੈਠ ਕੇ ਤੁਸੀਂ ਯੋਗਾ ਕਰ ਸਕਦੇ ਹੋ ਘਰ ਤੋਂ ਬਾਹਰ ਜਾਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਜਦੋਂ ਮੈਂ ਸਵੇਰ ਦੀ ਸੈਰ ਕਰਿਆ ਕਰਦੀ ਸੀ ਤਾਂ ਮੈਨੂੰ ਇਹ ਸਮੱਸਿਆ ਆਉਂਦੀ ਸੀ ਕਿ ਗਲੀ ਵਿਚਲੇ ਅਵਾਰਾ ਕੁੱਤੇ ਮਗਰ ਲੱਗ ਜਾਂਦੇ ਹਨ ਅਤੇ ਕਈ ਵਾਰ ਉਹ ਬਹੁਤ ਡਰਾ ਵੀ ਦਿੰਦੇ ਹਨ ਇਸ ਲਈ ਮੈਨੂੰ ਯੋਗਾ ਕਰਨਾ ਹੀ ਜ਼ਿਆਦਾ ਪਸੰਦ ਹੈ ਜਦੋਂ ਤੋਂ ਮੈਂ ਯੋਗਾ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਮੇਰੀ ਸਿਹਤ ਵਿੱਚ ਬਹੁਤ ਸੁਧਾਰ ਹੋਇਆ ਹੈ ਹੁਣ ਮੈਨੂੰ ਸਮੇਂ ਸਮੇਂ 'ਤੇ ਨੀਂਦ ਮਹਿਸੂਸ ਨਹੀਂ ਹੁੰਦੀ ਮੇਰੇ ਕੁਦਰਤੀ ਸਮੇਂ ਦੇ ਵਿੱਚ ਇੱਕ ਬੰਨ ਪੈ ਗਿਆ ਹੈ ਅਤੇ ਭੁੱਖ ਪਿਆਸ ਅਤੇ ਸੌਣ ਦਾ ਸਮਾਂ ਲਗਭਗ ਨਿਸ਼ਚਿਤ ਹੋ ਗਿਆ ਹੈ ਹੁਣ ਮੈਨੂੰ ਮੇਰੇ ਸਰੀਰ ਦਾ ਕਿਹਾ ਸਮਝ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਮੈਨੂੰ ਜਿੰਦਗੀ ਜਿਉਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਂਦੀ ਯੋਗਾ ਅਭਿਆਸ ਸਮੇਂ ਦੇ ਨਾਲ ਵਿਕਸਿਤ ਹੋ ਚੁੱਕਾ ਹੈ